ਪੰਜਾਬ ਵਿੱਚ ਮੁੱਖ ਸਰਕਾਰੀ ਮਾਲਕੀਅਤ ਵਾਲੇ ਜਾਂ ਨਿਯੰਤਰਿਤ ਉਦਮ ਇਹ ਹਨ ਜਿਵੇਂ ਕਿ ਪੰਜਾਬ ਫਾਈਨੈਂਸ਼ੀਅਲ ਕੋਰਪੋਰੇਸ਼ਨ ਪੰਜਾਬ ਫਾਈਨੈਂਸ਼ੀਅਲ ਕੋਰਪੋਰੇਸ਼ਨ ਵਿੱਚ ਇਹ ਹੈ ਜਿਵੇਂ ਕਿ ਸਰਕਾਰ ਖੁਦ ਤੈਅ ਕਰਦੀ ਹੈ ਕਿ ਉਸਨੇ ਕਿਸ ਨੂੰ ਕਿੰਨਾ ਫੰਡ ਦੇਣਾ ਹੈ ਕਿਸ ਨਾਲ ਕਿੰਨਾ ਰੇਟ ਕਰਨਾ ਹੈ ਅਤੇ ਕਿਸ ਨੂੰ ਵੱਧ ਦੇਣਾ ਹੈ ਕਿਸਨੂੰ ਘੱਟ ਦੇਣਾ ਹੈ ਇਹ ਸਾਰਾ ਹਿਸਾਬ ਕਿਤਾਬ ਸਰਕਾਰ ਹੀ ਕਰਦੀ ਹੈ ਅਤੇ ਪੰਜਾਬ ਸਟੇਟ ਵੇਅਰਹਾਊਸਿੰਗ ਪੰਜਾਬ ਸਟੇਟ ਵੇਅਰਹਾਊਸਿੰਗ ਵਿੱਚ ਉਹ ਆਪਣਾ ਸਮਾਨ ਹੈ ਜਿਹੜਾ ਉਹ ਬਚਾਅ ਕੇ ਰੱਖਦੀ ਹੈ ਜਿਵੇਂ ਕਿ ਅਨਾਜ ਲੋੜ ਪੈਣ 'ਤੇ ਉਹ ਸਾਰੇ ਦੇਸ਼ ਨੂੰ ਵੰਡ ਸਕਣ ਜਿੱਦਾਂ ਕਿ ਪਿੱਛੇ ਜਿਹੀ ਕਰੋਨਾ ਆਉਣ ਕਰਕੇ ਸਰਕਾਰ ਨੇ ਬਹੁਤ ਹੀ ਮਜ਼ਦੂਰਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਹੈਲਪ ਕੀਤੀ ਉਹਨਾਂ ਨੂੰ ਅਨਾਜ ਵੰਡਿਆ ਉਹਨਾਂ ਦੇ ਖਾਣ ਪੀਣ ਦੀ ਜਿੰਨੀ ਵੀ ਦਿੱਕਤ ਸੀ ਉਹ ਸਾਰੀ ਦੂਰ ਕੀਤੀ ਇਹ ਸਾਰਾ ਪੰਜਾਬ ਸਟੇਟ ਵੇਅਰਹਾਊਸਿੰਗ ਵਿੱਚ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਸੀ ਜਿਸ ਨਾਲ ਓਹ ਅਨਾਜ ਵੰਡ ਸਕਣ